ਮੈਨੂੰ ਨੈਚੁਰਲ ਡਰਾਇੰਗ ਬਣਾਉਂਣਾ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਜਿਵੇਂ ਕਿ ਸੂਰਜ ਛਿਪਦਾ ਹੋਇਆ ਅਤੇ ਚੜਦੇ ਹੋਏ ਦਾ ਦ੍ਰਿਸ਼ ਡਰਾਇੰਗ ਵਿੱਚ ਦਰਸਾਉਣਾ ਅਤੇ ਮੈਨੂੰ ਰਾਤ ਦਾ ਦ੍ਰਿਸ਼ ਦਰਸਾਉਂਣਾ ਵੀ ਬਹੁਤ ਵਧੀਆ ਲੱਗਦਾ ਹੈ ਮੈਨੂੰ ਇਹ ਚੀਜ਼ ਡਰਾਇੰਗ ਬਣਾ ਕੇ ਬਹੁਤ ਜ਼ਿਆਦਾ ਸ਼ਾਂਤੀ ਮਿਲਦੀ ਹੈ ਮੈਂ ਕਈ ਵਾਰ ਯੂਟੀਊਬ ਦੀ ਮਦਦ ਲੈਂਦੀ ਹਾਂ ਕਿਉਂਕਿ ਮੈਨੂੰ ਕਲਰ ਚੋਣ ਵਿੱਚ ਕਈ ਵਾਰ ਦਿੱਕਤ ਆਉਂਦੀ ਹੈ ਪਰ ਜ਼ਿਆਦਾਤਰ ਮੈਂ ਆਪਣੇ ਭਰਾ ਦੀ ਮਦਦ ਲੈਂਦੀ ਹਾਂ ਕਿਉਂਕਿ ਉਹ ਇੱਕ ਉਸ ਨੇ ਬਹੁਤ ਜ਼ਿਆਦਾ ਕੋਂਪੀਟੀਸ਼ਨ ਜਿੱਤੇ ਹੋਏ ਹਨ ਅਤੇ ਉਹ ਬਹੁਤ ਜ਼ਿਆਦਾ ਮੈਡਲ ਵੀ ਜਿੱਤ ਚੁੱਕਿਆ ਹੈ ਡਰਾਇੰਗ ਕੋਂਪੀਟੀਸ਼ਨ ਦੇ ਵਿੱਚ ਇਸ ਲਈ ਮੈਂ ਜ਼ਿਆਦਾਤਰ ਉਸ ਦੀ ਹੀ ਮਦਦ ਲੈਂਦੀ ਹਾਂ ਉਹ ਜਦੋਂ ਵੀ ਮੈਂ ਡਰਾਇੰਗ ਬਣਾਉਂਦੀ ਹਾਂ ਤਾਂ ਮੈਨੂੰ ਕਈ ਵਾਰ ਕਲਰ ਦੀ ਚੋਣ ਕਰਨ ਵਿੱਚ ਪ੍ਰੋਬਲਮ ਆਉਂਦੀ ਹੈ ਹਾਲ ਹੀ ਵਿੱਚ ਮੈਂ ਇੱਕ ਡਰਾਇੰਗ ਬਣਾਈ ਸੀ ਜਿਸ ਵਿੱਚ ਮੈਂ ਸੂਰਜ ਛਿਪਦੇ ਹੋਏ ਦਾ ਦ੍ਰਿਸ਼ ਦਰਸਾਇਆ ਸੀ ਨ ਇੱਕ ਮਹੀਨਾ ਪਹਿਲਾਂ ਮੈਂ ਅਤੇ ਮੇਰੀ ਪੂਰੀ ਫੈਮਿਲੀ ਕੈਂਪ ਲਗਾਉਣ ਲਈ ਪਹਾੜਾਂ ਵਿੱਚ ਗਏ ਸਾਂ ਉੱਥੇ ਜਦੋਂ ਮੈਂ ਪਹਾੜਾਂ ਵਿੱਚ ਦੀ ਸੂਰਜ ਛਿਪਦਾ ਹੋਇਆ ਦੇਖਿਆ ਤਾਂ ਮੈਨੂੰ ਉਹ ਦ੍ਰਿਸ਼ ਬਹੁਤ ਜ਼ਿਆਦਾ ਵਧੀਆ ਲੱਗਿਆ ਉਸ ਨੂੰ ਦੇਖ ਕੇ ਮੈਂ ਸੋਚਿਆ ਕਿ ਮੈਂ ਘਰ ਜਾ ਕੇ ਇਹ ਹੀ ਡਰਾਇੰਗ ਬਣਾਉਣੀ ਹੈ ਅਤੇ ਘਰ ਆਉਣ ਸਾਰ ਮੈਂ ਉਹ ਡਰਾਇੰਗ ਬਣਾਈ ਜਿਹੜੀ ਕਿ ਬਹੁਤ ਜ਼ਿਆਦਾ ਵਧੀਆ ਬਣੀ ਸੀ ਅਤੇ ਉਹ ਡਰਾਇੰਗ ਮੈਂ ਆਪਣੇ ਇੰਸਟਾਗਰਾਮ ਚੈਨਲ ਉੱਤੇ ਵੀ ਅਪਲੋਡ ਕੀਤੀ ਜਿਸ ਕਰਕੇ ਮੈਨੂੰ ਬਹੁਤ ਜ਼ਿਆਦਾ ਲਾਈਕ ਆਏ ਧੰਨਵਾਦ